ਐਵੇਂ ਤਾਂ ਸਕੂਲ ਦੇ ਵਿੱਚ ਬਹੁਤ ਸਾਰੇ ਵਿਸ਼ੇ ਸੀ ਜੋ ਮੇਰੇ ਮਨਪਸੰਦ ਸੀ ਪਰ ਉਹਨਾਂ ਵਿੱਚੋਂ ਇੱਕ ਵਿਸ਼ਾ ਸੀ ਕੰਪਿਊਟਰ ਦਾ ਜਿਹੜਾ ਕਿ ਮੈਨੂੰ ਜਦ ਵੀ ਕੰਪਿਊਟਰ ਦਾ ਲੈਕਚਰ ਆਉਣਾ ਤਾਂ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਕੰਪਿਊਟਰ ਦੇ ਵਿਸ਼ੇ ਵਿੱਚ ਮੈਨੂੰ ਹੁਣ ਅੱਜ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲੂਗਾ ਨਵੀਂ ਟੈਕਨੋਲਜੀ ਨਾਲ ਕਿਸ ਤਰ੍ਹਾਂ ਜੂਝਣਾ ਉਹ ਸਿੱਖਣ ਦਾ ਮੌਕਾ ਮਿਲੂਗਾ ਤਾਂ ਮੈਨੂੰ ਉਸ ਟਾਈਮ ਇਹ ਲੱਗ ਗਿਆ ਸੀ ਕਿ ਅਗਰ ਮੈਂ ਫਿਊਚਰ ਦੇ ਵਿੱਚ ਗ੍ਰੈਜੂਏਸ਼ਨ ਕਰਨੀ ਹੈ ਆਫਟਰ ਪਲੱਸ ਟੂ ਤਾਂ ਮੈਂ ਉਹ ਕੰਪਿਊਟਰ ਦੇ ਵਿਸ਼ੇ ਵਿੱਚ ਹੀ ਅੱਗੇ ਵਧੂੰਗੀ ਸੋ ਤਾਂ ਹੀ ਮੈਂ ਬੀ ਟੈਕ ਕੰਪਿਊਟਰ ਸਾਇੰਸ ਦੇ ਵਿੱਚ ਐਡਮਿਸ਼ਨ ਲਈ ਸੀ ਆਫਟਰ ਪਲੱਸ ਟੂ ਤਾਂ ਕੰਪਿਊਟਰ ਇੱਕ ਮੇਰਾ ਬਹੁਤ ਹੀ ਮਨਪਸੰਦ ਵਿਸ਼ਾ ਰਿਹਾ ਹੈ ਜਿਹਦੇ ਵਿੱਚ ਮੈਂ ਆਪਣਾ ਹੰਡਰਡ ਪ੍ਰਸੈਂਟ ਦੇ ਪਾਉਂਦੀ ਸੀ ਅਤੇ ਮੈਨੂੰ ਉਹਦੇ ਵਿੱਚ ਵੱਖ ਵੱਖ ਚੀਜ਼ਾਂ ਸਿੱਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀ